ਕਿਤਾਬਾਂ ਤੋਂ ਬਿਨ੍ਹਾਂ ਮੈਨੂੰ ਅਖ਼ਬਾਰ ਮੈਗਜ਼ੀਨ ਬਲੋਗ ਪੜ੍ਹਨ ਦਾ ਬਹੁਤ ਸ਼ੌਂਕ ਹੈ ਜਦੋਂ ਵੀ ਮੇਰੇ ਕੋਲ ਫ੍ਰੀ ਸਮਾਂ ਹੁੰਦਾ ਹੈ ਤਾਂ ਮੈਂ ਉਸ ਸਮੇਂ ਦੇ ਵਿੱਚ ਮੈਗਜ਼ੀਨ ਅਖ਼ਬਾਰ ਜਾਂ ਆਰਟੀਕਲ ਪੜ੍ਹਦਾ ਹਾਂ ਅਤੇ ਜਿਨ੍ਹਾਂ ਤੋਂ ਮੈਨੂੰ ਸਿੱਖਣ ਨੂੰ ਮਿਲਦਾ ਹੈ